ਮੇਰੇ ਖਿਆਲ ਵਿੱਚ ਆਧੁਨਿਕ ਭਾਸ਼ਾ ਪੰਜਾਬੀ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਲਗਾਉਂਦੇ ਹਾਂ ਪੰਜਾਬ ਵਿੱਚ ਰਹਿੰਦੇ ਹੋਏ ਵੀ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਨਾ ਹੀ ਸਾਡੇ ਬੱਚੇ ਉਹਨਾਂ ਸਕੂਲਾਂ ਵਿੱਚ ਪੰਜਾਬੀ ਚੰਗੀ ਤਰ੍ਹਾਂ ਬੋਲ ਸਕਦੇ ਹਨ ਜਦਕਿ ਜਦੋਂ ਇਹ ਸਕੂਲ ਸਾਰੇ ਪੰਜਾਬ ਵਿੱਚ ਪੰਜਾਬੀ ਵਿੱਚ ਹੀ ਹੋਣੇ ਚਾਹੰਦੇ ਹਨ ਹੋਣੇ ਚਾਹੀਦੇ ਹਨ ਪਰ ਅਸੀਂ ਵਧੀਆ ਫਿਊਚਰ ਕਰਕੇ ਇਹ ਪੱਛਮੀ ਸੱਭਿਆਚਾਰ ਨੂ ਵੱਲ ਨੂੰ ਹੀ ਜ਼ਿਆਦਾ ਕਰ ਰਹੇ ਹਾਂ ਵੀ ਅਸੀਂ ਉਹਨਾਂ ਵੱਲ ਨੂੰ ਜ਼ਿਆਦਾ ਅਟਰੈਕਟ ਹੋ ਰਹੇ ਹਾਂ ਪਰ ਸਾਨੂੰ ਇਹ ਕਰਨਾ ਨਹੀਂ ਚਾਹੀਦਾ ਸਾਨੂੰ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀਅਤ ਦਾ ਸਾਹਮਣਾ ਵਧੀਆ ਢੰਗ ਨਾਲ ਹੀ ਕਰਨਾ ਚਾਹੀਦਾ ਆ ਇਸ ਕਰਕੇ ਜਿੱਦਾਂ ਕਿ ਅਸੀਂ ਸਕੂਲ ਪੇਰੈਂਟਸ ਮੀਟਿੰਗ 'ਤੇ ਜਾਂਦੇ ਹਾਂ ਉੱਥੇ ਜਿਹੜੇ ਸਾਨੂੰ ੲਹ ਇਹ ਹਿਦਾਇਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰਨੀ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੰਗਲਿਸ਼ ਔਰ ਹਿੰਦੀ ਨਾਲ ਹੀ ਕਰਨਾ ਆ ਸਮਝਾਉਣਾ ਆ ਪੜ੍ਹਾਉਣਾ ਆ ਘਰ ਵੀ ਅਤੇ ਸਾਡਾ ਬੱਚਾ ਉਸ ਚੀਜ਼ ਵੱਲ ਨੂੰ ਜ਼ਿਆਦਾ ਅਟਰੈਕਟ ਹੁੰਦਾ ਆਧੁਨਿਕ ਭਾਸ਼ਾ ਵੱਲ ਨੂੰ ਜ਼ਿਆਦਾ ਹੁੰਦਾ ਆ ਪਰ ਜੇ ਅਸੀਂ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਜ਼ਿਆਦਾ ਪੰਜਾਬੀ ਸੌਖੀ ਭਾਸ਼ਾ ਆ ਔਰ ਬੱਚਿਆਂ ਨੂੰ ਵੀ ਸੋ ਇਹੀ ਚੀਜ਼ ਬੋਲਣੀ ਚਾਹੀਦੀ ਹੈ